ਟੈਕਨੋਲਜੀ ਅਤੇ ਇੰਟਰਨੈੱਟ ਦੇ ਵਧਣ ਨਾਲ ਪੰਜਾਬੀ ਭਾਸ਼ਾ ਵਿੱਚ ਬਹੁਤ ਫਰਕ ਆਇਆ ਹੈ ਜੋ ਕਿ ਸਾਨੂੰ ਦੇਖਣ ਨੂੰ ਵੀ ਮਿਲ ਰਿਹਾ ਹੈ ਡੇ ਬਾਏ ਡੇ ਪੰਜਾਬੀ ਭਾਸ਼ਾ ਹੌਲੀ ਹੌਲੀ ਖਤਮ ਹੋ ਰਹੀ ਹੈ ਜਿਹ ਜਿਹੜੇ ਆਪਾਂ ਕਈ ਸਕੂਲਾਂ ਵਿੱਚ ਜਾਂਦੇ ਵੱਡੇ ਸਕੂਲਾਂ ਵਿੱਚ ਉਹ ਸਕੂਲਾਂ ਵਿੱਚ ਦੇਖਦੇ ਕਿ ਕਈ ਪੰਜਾਬੀ ਭਾਸ਼ਾ ਬੋਲਣ ਵਾਲੇ ਬੱਚਿਆਂ ਨੂੰ ਅਲਾਓ ਨਹੀਂ ਕਰਦੇ ਪੰਜਾਬੀ ਫੈਮਲੀ ਵਾਲਿਆਂ ਨੂੰ ਅਲਾਓ ਨਹੀਂ ਕਰਦੇ ਹੈ ਬੋਲਣ ਲਈ ਇਹ ਦੇਖਣ ਨੂੰ ਮਿਲ ਰਿਹਾ ਇਹ ਸਾਨੂੰ ਖਾਸ ਧਿਆਨ ਰੱਖਣਾ ਪੈਂਦਾ ਏ ਰੱਖਣਾ ਪੈਣਾ ਹੈ ਕਿਉਂਕਿ ਪੰਜਾਬੀ ਭਾਸ਼ਾ ਡੇ ਬਾਏ ਡੇ ਖਤਮ ਹੋ ਰਿਹਾ ਏ ਇਹ ਕਈ ਭਾਸ਼ਾਵਾਂ ਕਈ ਲੈਂਗੁਏਜ ਕੋਈ ਸ਼ਬਦ ਇੱਦਾਂ ਦੇ ਵੀ ਹੈ ਜੋ ਸਾਨੂੰ ਨਹੀਂ ਪਤਾ ਲੱਗਦਾ ਉਹ ਵੀ ਸਾਨੂੰ ਗੂਗਲ ਟਰਾਂਸਲੇਟਰ ਲੱਭ ਕੇ ਦੇ ਰਿਹਾ ਏ ਇੰਟਰਨੈੱਟ ਦੇ ਵਧਣ ਨਾਲ ਆਹ ਵੀ ਫਾਇਦਾ ਸਾਨੂੰ ਹੋਇਆ ਏ ਇਹਦੇ ਵਧਣ ਨਾਲ ਆਹ ਵੀ ਫਾਇਦਾ ਹੋਇਆ ਹੈ ਅਤੇ ਕਈ ਇਹਨਾਂ ਦੇ ਚੱਕਰਾਂ 'ਚ ਕਈ ਸਾਨੂੰ ਹੋਰ ਭਾਸ਼ਾਵਾਂ ਦੇ ਆਉਣ ਕਰਕੇ ਪੰਜਾਬੀ ਭਾਸ਼ਾ ਥੱਲੇ ਜਾਈ ਜਾ ਰਹੀ ਹੈ ਇਹਨਾਂ ਨੂੰ ਆਪਾਂ ਧਿਆਨ ਵਿੱਚ ਰੱਖਣਾ ਚਾਹੀਦਾ ਸਾਨੂੰ ਪੰਜਾਬੀ ਭਾਸ਼ਾ ਸਾਡੀ ਮਾਤਰ ਬੋਲੀ ਹੈ ਇਹਨੂੰ ਆਪਣਾ ਧਿਆਨ 'ਚ ਰੱਖਣਾ ਪੈਂਦਾ ਏ